ਮੈਂ ਕਦੇ ਵੀ ਕੋਈ ਬੁਣਾਈ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਲੇਕਿਨ ਮੇਰੀ ਨਾਨੀ ਦਾਦੀਆਂ ਇਹ ਬੁਣਾਈ ਦਾ ਇਹਨਾਂ ਨੂੰ ਬੁਣਾਈ ਦਾ ਸ਼ੌਕ ਸੀ ਅਤੇ ਇਹਨਾਂ ਨੂੰ ਸਿਖਾਇਆ ਵੀ ਜਾਂਦਾ ਸੀਗਾ ਅਤੇ ਸਿੱਖੇ ਵੀ ਹੋਏ ਨੇ ਅਤੇ ਬਹੁਤ ਵਧੀਆ ਬੁਣਾਈ ਸਿਲਾਈ ਕਰਦੇ ਨੇ ਲੇਕਿਨ ਮੈਨੂੰ ਸਿਲਾਈ ਬੁਣਾਈ ਨਹੀਂ ਆਉਂਦੀ ਅਤੇ ਨਾ ਮੈਂ ਕਦੇ ਕੋਸ਼ਿਸ਼ ਕੀਤੀ ਹੈ